ਹਾਂਜੀ ਅਸੀਂ ਇੱਕ ਤਿਉਹਾਰ ਮਨਾ ਰਹੇ ਹਾਂ ਤੀਆਂ ਦਾ ਤਿਉਹਾਰ ਹੈ ਇਹ ਤਿਉਹਾਰ ਲਈ ਅਸੀਂ ਭੋਜਨ ਓਡਰ ਕਰਨਾ ਸੀ ਕਿਸੇ ਪੈਲਸ ਦੇ ਵਿੱਚ ਇਹ ਤਿਓਹਾਰ ਤੀਆਂ ਦਾ ਮਨਾ ਰਹੇ ਹਾਂ ਸਾਰੀਆਂ ਜਾਣੀਆਂ ਸਹੇਲੀਆਂ ਕਿਰਪਾ ਕਰਕੇ ਸਾਡਾ ਇਹ ਓਡਰ ਨੋਟ ਕਰ ਲਓ ਜੀ ਇਹਦੇ ਵਿੱਚ ਇਹ ਹੈ ਜੀ ਜੋ ਜੋ ਆਈਟਮਾਂ ਅਸੀਂ ਮੰਗਵਾ ਰਹੇ ਆ ਉਹ ਲਿਖ ਲਓ ਜੀ ਜਿਵੇਂ ਪਨੀਰ ਟਿੱਕਾ ਅਤੇ ਮਨਚੁਰੀਅਨ ਠੀਕ ਹੈ ਆਈਸਕ੍ਰੀਮ ਵਗੈਰਾ ਇਹ ਚੀਜ਼ਾਂ ਹੋਣਗੀਆਂ ਨਾਲ ਨਾਲ ਸ਼ਾਹੀ ਪਨੀਰ ਦਾਲ ਮਖਣੀ ਰਾਈਸ ਇੱਦਾਂ ਦੀਆਂ ਓਹੀ ਸਭ ਨਾਲ ਚਪਾਤੀ ਵਗੈਰਾ ਚਾਵਲ ਇਹ ਸਾਰਾ ਕੁਛ ਤੁਸੀਂ ਨਾਲ ਦੇਣਾ ਅਤੇ ਇਹਦਾ ਸਾਡਾ ਜਿਹੜਾ ਓਡਰ ਹੈ ਜੀ ਇਹ ਬੱਤੀ ਫਰਵਰੀ ਨੂੰ ਲੈ ਕੇ ਆਉਣਾ ਜੀ ਦੋ ਹਜ਼ਾਰ ਪੰਜਾਹ ਨੂੰ ਅਤੇ ਉਦੋਂ ਤੁਸੀਂ ਇਹ ਸਾਨੂੰ ਦੱਸ ਦਿਓ ਇਹ ਨਾ ਇੱਥੇ ਇੱਕ ਪਿੰਡ ਪੈਂਦਾ ਚਿੱਬੜ ਚੋਧ ਉੱਥੇ ਇੱਕ ਪੈਲਸ ਉਹਦੇ ਵਿੱਚ ਤੁਸੀਂ ਇਹ ਪੈਸੇ ਵੀ ਇਹ ਸਾਡੇ ਕੋਲ ਓਡਰ ਪਹੁੰਚਾਉਣਾ ਕਿਰਪਾ ਕਰਕੇ ਸਾਨੂੰ ਦੱਸੋ ਅਤੇ ਨਾਲੇ ਸਾਨੂੰ ਇਹ ਦੱਸੋ ਕਿ ਇਹਦੇ 'ਚ ਤੁਹਾਨੂੰ ਕਿੰਨੀ ਕੁ ਛੋਟ ਕਰੋਗੇ ਸੱਠ ਬੰਦਿਆਂ ਦਾ ਸਮਾਨ ਪਹੁੰਚਾਉਣਾ ਜੀ ਇੱਥੇ ਸਾਨੂੰ ਕਿਰਪਾ ਕਰਕੇ ਸਾਨੂੰ ਦੱਸੋ ਜਲਦੀ ਅਤੇ ਨਾਲੇ ਛੋਟ ਦੱਸੋ ਕੀ ਕਰੋਗੇ